ਪੰਜਾਬੀ ਸੱਭਿਆਚਾਰ ਬਹੁਤ ਹੀ ਅਮੀਰ ਸੱਭਿਆਚਾਰ ਹੈ ਪੰਜਾਬ ਦੇ ਵਾਸੀਆਂ ਨੇ ਇਸ ਸੱਭਿਆਚਾਰ ਨੂੰ ਬਹੁਤ ਹੀ ਸਾਂਭ ਕੇ ਰੱਖਿਆ ਅਤੇ ਦੁਨੀਆ ਭਰ ਵਿੱਚ ਦਿਨ ਵੇ ਦਿਨ ਇਸ ਨੂੰ ਵਿਕਸਿਤ ਵੀ ਕੀਤਾ ਹੈ ਜਿਵੇਂ ਜਿਵੇਂ ਸਾਡੇ ਪੰਜਾਬੀ ਲੋਕ ਬਾਹਰਲੀਆਂ ਕੰਟਰੀਆਂ ਦੇ ਵਿੱਚ ਜਾ ਵੱਸੇ ਹਨ ਅਤੇ ਉੱਥੋਂ ਹੀ ਪੰਜਾਬੀ ਸੱਭਿਆਚਾਰ ਉੱਥੇ ਉੱਥੇ ਹੀ ਪਹੁੰਚ ਗਿਆ ਹੈ ਪੰਜਾਬ ਵਿੱਚ ਬਹੁਤ ਹੀ ਕਲਾਕਾਰ ਹਨ ਪੰਜਾਬੀ ਕਲਾਕਾਰ ਜੋ ਕਿ ਅਲੱਗ ਅਲੱਗ ਲੋਕ ਗੀਤਾਂ ਰਾਹੀਂ ਸਾਡਾ ਸੱਭਿਆਚਾਰ ਸਾਡਾ ਮਨੋਰੰਜਨ ਵੀ ਕਰਦੇ ਆ ਅਤੇ ਨਾਲ ਨਾਲ ਸਾਡੇ ਸੱਭਿਆਚਾਰ ਨੂੰ ਵੀ ਵਿਕਸਿਤ ਕਰਦੇ ਆ ਪੰਜਾਬ ਦੇ ਕਲਾਕਾਰ ਲੇਖਕ ਅਤੇ ਵੀਡੀਓ ਐਡੀਟਰ ਪੰਜਾਬ ਦੇ ਸੱਭਿਆਚਾਰ ਨੂੰ ਲੈ ਕੇ ਉਹੋ ਜਿਹੇ ਗਾਣੇ ਪੇਸ਼ ਕਰਦੇ ਆ ਸਾਡੇ ਤਾਈਂ ਜੋ ਕਿ ਇੱਕ ਆਮ ਪਰਿਵਾਰ ਵਿੱਚ ਬੈਠ ਕੇ ਅਸੀਂ ਦੇਖ ਸਕੀਏ ਅਤੇ ਆਨੰਦ ਮਾਣ ਸਕੀਏ ਪੰਜਾਬ ਦਾ ਪਹਿਰਾਵਾ ਵੀ ਲੋਕ ਗੀਤਾਂ ਰਾਹੀਂ ਸਾਰੇ ਸੰਸਾਰ ਵਿੱਚ ਬਹੁਤ ਮਸ਼ਹੂਰ ਹੈ ਪਹਿਰਾਵੇ ਤੋਂ ਇਲਾਵਾ ਪੰਜਾਬੀ ਔਰਤਾਂ ਦਾ ਸ਼ਿੰਗਾਰ ਅਤੇ ਪੰਜਾਬ ਦਾ ਖਾਣ ਪੀਣ ਜੋ ਵੀ ਹੈ ਸਭ ਲੋਕ ਗੀਤਾਂ ਰਾਹੀਂ ਚਲਾਇਆ ਜਾਂਦਾ ਹੈ ਸਮੇਂ ਦੀ ਦੌੜ ਅਤੇ ਪੱਛਮੀ ਸੱਭਿਆਚਾਰ ਦਾ ਪ੍ਰਭਾਵ ਹੋਣ ਕਰਕੇ ਇਸ ਨੂੰ ਲੋਕ ਥੋੜ੍ਹਾ ਅਲੋਪ ਕਰਦੇ ਜਾ ਰਹੇ ਕਿ ਪੱਛਮੀ ਸੱਭਿਅਤਾ ਅਪਣਾ ਰਹੇ ਆ ਅਤੇ ਪੰਜਾਬ ਦੇ ਵਿਰਸੇ ਨੂੰ ਕਿਤੇ ਨਾ ਕਿਤੇ ਭੁੱਲਦੇ ਜਾ ਰਹੇ ਹੈ ਜੋ ਕਿ ਸਾਡੇ ਲਈ ਕੋਈ ਸਲਾਹੁਣਯੋਗ ਗੱਲ ਨਹੀਂ ਹੈ ਕਿਉਂਕਿ ਪੰਜਾਬੀ ਹੋਣ ਦੇ ਨਾਤੇ ਸਾਨੂੰ ਸਾਡਾ ਇਹ ਫਰਜ਼ ਬਣਦਾ ਕਿ ਪੰਜਾਬ ਰਾਜ ਦੀ ਕਲਾ ਅਤੇ ਸੱਭਿਆਚਾਰ ਨੂੰ ਜਿਉਂਦੇ ਰੱਖਣਾ ਸਾਡੀ ਜ਼ਿੰਮੇਵਾਰੀ ਹੈ ਧੰਨਵਾਦ